ਹੈਲੋ ਹਾਂਜੀ ਮੇਰੀ ਗੱਲ ਦਾਵਤ ਵਾਲਿਆਂ ਨਾਲ ਹੋ ਰਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਮੈਂ ਨਾ ਔਡਰ ਕੀਤਾ ਸੀ ਮੇਰਾ ਨਾਮ ਪ੍ਰਿਅੰਕਾ ਹੈ ਹਾਂਜੀ ਔਡਰ ਨੰਬਰ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਦੇਖ ਕੇ ਦੱਸ ਦੀ ਹਾਂਜੀ ਔਡਰ ਨੰਬਰ ਪੈਂਤੀ ਹਾਂਜੀ ਮੈਂ ਨਾ ਤੁਹਾਡੇ ਢਾਬੇ ਤੋਂ ਦਾਲ ਮੱਖਣੀ ਸ਼ਾਹੀ ਪਨੀਰ ਅਤੇ ਨਾਨ ਵਾਲੇ ਪਰੌਂਠੇ ਕੀਤੇ ਸੀ ਹਾਂਜੀ ਅਤੇ ਮੈਨੂੰ ਹੁਣੇ ਡਿਲੀਵਰੀ ਬੋਏ ਇੱਕ ਪਾਰਸਲ ਫੜਾ ਕੇ ਗਿਆ ਉਹਦੇ ਵਿੱਚ ਸ਼ਾਹੀ ਪਨੀਰ ਹੈ ਅਤੇ ਨਾਲ ਉਹਦੇ ਵਿੱਚ ਸਿੰਪਲ ਪਰੌਂਠੇ ਹਨ ਹਾਂਜੀ ਅਤੇ ਉੱਪਰ ਅਡਰੈਸ ਵੀ ਉੱਥੇ ਗਲਤ ਹੀ ਲਿਖਿਆ ਹੋਇਆ ਉੱਪਰ ਮੇਰਾ ਐਡਰੈਸ ਹੈਗਾ ਪ੍ਰਤਾਪ ਨਗਰ ਗਲੀ ਨੰਬਰ ਦੋ ਹਾਂਜੀ ਗਲੀ ਦੇ ਵਿੱਚ ਚੌਥਾ ਘਰ ਹੈ ਸਾਡਾ ਅਤੇ ਇੱਥੇ ਐਡਰੈਸ ਵੀ ਕੋਈ ਹੋਰ ਹੀ ਗਲਤ ਲਿਖਿਆ ਹੋਇਆ ਕਿਸੇ ਦਾ ਹਾਂਜੀ ਹਾਂਜੀ ਹਾਂਜੀ ਮੈਨੂੰ ਲੱਗਦਾ ਉਹ ਡਿਲੀਵਰੀ ਬੋਆਏ ਨਾ ਗਲਤੀ ਦੇ ਨਾਲ ਹਫਰਾ ਦਫਰੀ ਦੇ ਵਿੱਚ ਮੈਨੂੰ ਗਲਤ ਪਾਰਸਲ ਫੜਾ ਗਿਆ ਅਤੇ ਤੁਸੀਂ ਕਿਰਪਾ ਕਰਕੇ ਆਪਣੇ ਜਲਦੀ ਤੋਂ ਜਲਦੀ ਹੋ ਸਕੇ ਤੁਸੀਂ ਆਪਣੇ ਡਿਲੀਵਰੀ ਬੋਆਏ ਦੇ ਨਾਲ ਕੋਂਟੈਕਟ ਕਰੋ ਅਤੇ ਹਾਂਜੀ ਉਹਨੂੰ ਕਹੋ ਕਿ ਤੁਸੀਂ ਇੱਦਾਂ ਇੱਦਾਂ ਕਿ ਗਲਤ ਪਾਰਸਲ ਫੜਾ ਗਏ ਹੋ ਹਾਂਜੀ ਜਿੰਨੀ ਜਲਦੀ ਹੋ ਸਕੇ ਕਰੋ ਮੇਰੇ ਘਰੇ ਨਾ ਪਰੋਣੇ ਆਏ ਨੇ ਅਤੇ ਮੈਂ ਉਨ੍ਹਾਂ ਨੂੰ ਰੋਟੀ ਖਵਾਉਣੀ ਸੀ ਹਾਂਜੀ ਅਤੇ ਤੁਸੀਂ ਜਾਂ ਫਿਰ ਇੱਦਾਂ ਕਰੋ ਕਿ ਜਿਹੜੇ ਮੈਂ ਤੁਹਾਨੂੰ ਪੈਸੇ ਪਾਏ ਨੇ ਤੁਸੀਂ ਮੇਰੇ ਰਿਫੰਡ ਕਰ ਦਿਓ ਜੇ ਤੁਸੀਂ ਪੈਸੇ ਰਿਫੰਡ ਕਰ ਸਕਦੇ ਹੋ ਅਤੇ ਮੈਂ ਤੁਹਾਨੂੰ ਆਪਣਾ ਪੇ ਟੀ ਐੱਮ ਸੈਂਡ ਕਰ ਦਿੰਦੀ ਹਾਂ ਹਾਂਜੀ ਤੁਸੀਂ ਹਾਂਜੀ ਮੈਨੂੰ ਉਹ ਰਿਫੰਡ ਕਰ ਦਿਓ ਮੇਰੇ ਪੈਸੇ ਹਾਂਜੀ ਅਤੇ ਤੁਸੀਂ ਜਲਦੀ ਤੋਂ ਜਲਦੀ ਹੋ ਸਕੇ ਆਪਣੇ ਡਿਲੀਵਰ ਬੋਆਏ ਦੇ ਨਾਲ ਕੋਂਟੈਕਟ ਕਰਕੇ ਉਹਨੂੰ ਦੱਸੋ ਕਿ ਇਹ ਖਾਣਾ ਸਾਡੇ ਘਰੋਂ ਲੈ ਜਾਵੇ ਹਾਂਜੀ ਹਾਂਜੀ ਓਕੇ ਓਕੇ ਭਾਅ ਜੀ ਧੰਨਵਾਦ ਜੀ ਧੰਨਵਾਦ